ਮੈਂ ਸਰਕਾਰ ਤੋਂ ਉਮੀਦ ਕਰਦੀ ਹਾਂ ਕਿ ਸਾਡੇ ਸ਼ਹਿਰ ਨੂੰ ਸਿਹਤ ਨੂੰ ਅਤੇ ਆਵਾਜਾਈ ਅਤੇ ਹੋਰ ਚੀਜ਼ਾਂ ਨੂੰ ਬਿਹਤਰ ਕੀਤਾ ਜਾਵੇ ਮੈਂ ਸਰਕਾਰ ਤੋਂ ਮਦਦ ਕਰਦੀ ਹਾਂ ਮਦਦ ਮੰਗਦੀ ਹਾਂ ਕਿ ਸਾਡੀ ਸਿਹਤ ਵਾਸਤੇ ਪਿੰਡਾਂ ਵਿੱਚ ਜਗ੍ਹਾ ਜਗ੍ਹਾ ਮੈਡੀਕਲ ਸਟੋਰ ਫ੍ਰੀ ਮੈਡੀਕਲ ਸਟੋਰ ਦਿੱਤੇ ਜਾਨ ਸੜਕਾਂ ਨੂੰ ਸਹੀ ਕੀਤਾ ਜਾਵੇ ਰੋਡ ਜਿਹੜੇ ਹੈ ਹਰ ਪਿੰਡ ਦੇ ਹਰ ਸ਼ਹਿਰ ਦੇ ਰੋਡ ਅੱਛੇ ਬਣਨ ਔਰ ਸਭ ਤੋਂ ਇੰਪੋਰਟੈਂਟ ਚੀਜ਼ ਹੈ ਸਾਡੇ ਆਵਾਜਾਈ ਦੇ ਜੋ ਸੋਰਸ ਹੈ ਡੇਲੀ ਲੋਕ ਨੇ ਜੋ ਇੰਨਾਂ ਜ਼ਿਆਦਾ ਅਫੋਰਡ ਨਹੀਂ ਕਰ ਸਕਦੇ ਡੇਲੀ ਜਾਣਾ ਆਉਣਾ ਔਰ ਕਿਰਾਏ ਉਹ ਇੱਕ ਫ੍ਰੀ ਜ਼ਰੂਰ ਲਗਾਉਣਾ ਚਾਹੀਦਾ ਹਰ ਪਿੰਡ ਹਰ ਸ਼ਹਿਰ ਦੇ ਲਈ ਅਲੱਗ ਤੋਂ ਵਹੀਕਲ ਦੇਣੇ ਚਾਹੀਦੇ ਹਨ ਜਿਹੜੇ ਸ਼ਹਿਰਾਂ ਦੇ ਵਹੀਕਲ ਨੇ ਉਹ ਅਲੱਗ ਹੋਣੇ ਚਾਹੀਦੇ ਨੇ ਪਿੰਡਾਂ ਦੇ ਲੋਕਾਂ ਨੂੰ ਸ਼ਹਿਰਾਂ ਦੇ ਰੋਜ਼ਗਾਰਾਂ 'ਤੇ ਪਹੁੰਚਣ ਦੇ ਵਹੀਕਲ ਅਲੱਗ ਹੋਣੇ ਚਾਹੀਦੇ ਨੇ ਤਾਂ ਕਿ ਆਉਣ ਜਾਣ ਵਾਲੇ ਬੱਚਿਆਂ ਨੂੰ ਸੁਖਾਲਾ ਲੱਗ ਸਕੇ ਇਹਦੇ ਵਿੱਚ ਵੀ ਜ਼ਰੂਰ ਛੂਟ ਦੇਣੀ ਚਾਹੀਦੀ ਨੇ ਇੱਕ ਤਾਂ ਬੱਚੇ ਪੜ੍ਹਨ ਜਾਂਦੇ ਨੇ ਉਹਨਾਂ ਦਾ ਉਹ ਵਾਲਾ ਖਰਚਾ ਲੱਗਦਾ ਪਲਸ ਉਹਨਾਂ ਦੇ ਜਾਣ ਆਉਣ ਦਾ ਖਰਚਾ ਦੂਸਰਾ ਹੈ ਸਿਹਤ ਸਿਹਤ ਵੀ ਇੱਕ ਬਹੁਤ ਹੀ ਵੱਡਾ ਪੱਖ ਹੈ ਇਹਦੇ ਨੂੰ ਲੈ ਕੇ ਕਿਉਂਕਿ ਸਿਹਤ ਨੂੰ ਲੈ ਕੇ ਲੋਕਾਂ ਨੂੰ ਬਹੁਤ ਜ਼ਿਆਦਾ ਖਰਚਾ ਕਰਨਾ ਪੈਂਦਾ ਕਈ ਲੋਕਾਂ ਦੀ ਸਿਹਤ ਜ਼ਿਆਦਾ ਦਵਾਈਆਂ ਹੋਸ ਹੋਸਪਿਟਲਾਂ ਨੂੰ ਅਫੋਰਡ ਨਹੀਂ ਕਰ ਸਕਦੇ ਸੋ ਹਰ ਪਿੰਡ 'ਚ ਹਰਸ਼ ਹਰਜ਼ ਹਰ ਇੱਕ ਪਿੰਡ 'ਚ ਇੱਕ ਫ੍ਰੀ ਮੈਡੀਕਲ ਸਟੋਰਜ ਜ਼ਰੂਰ ਹੋਣਾ ਚਾਹੀਦਾ ਹੈ ਜਿੱਥੋਂ ਕੀ ਲੋਕ ਆਪਣੇ ਦਵਾਈਆਂ ਲੈ ਸਕਣ ਸਿੱਖਿਆ ਸਿੱਖਿਆ ਦਾ ਪੱਧਰ ਪਿੰਡਾਂ ਦੇ ਉੱਤੇ ਅੱਛਾ ਕਰਨਾ ਬਹੁਤ ਜ਼ਰੂਰੀ ਹੈ ਅਗਰ ਪਿੰਡਾਂ ਦੇ ਪੱਧਰ ਦੇ ਉੱਪਰ ਸਿੱਖਿਆ ਅੱਛੀ ਹੋ ਜਾਏ ਅਤੇ ਲੋਕ ਅੱਛੀ ਤਰੀਕੇ ਦੇ ਨਾਲ ਆਪਣੇ ਜੀਵਨ ਨੂੰ ਹੋਰ ਵੀ ਵਧੀਆ ਕਰ ਸਕਦੇ ਹਾਂ ਸੋ ਮੈਂ ਉਮੀਦ ਕਰਦੀ ਹਾਂ ਇਹ ਸਭ ਚੀਜ਼ਾਂ ਨੂੰ ਬਿਹਤਰ ਬਣਾਣਾ ਚਾਹੀਦਾ ਹੈ ਇਹਨਾਂ ਚੀਜ਼ਾਂ ਨੂੰ ਬਿਹਤਰ ਬਣਾਉਣ ਦੇ ਲਈ ਪੂਰਾ ਯੋਗਦਾਨ ਚਾਹੀਦਾ ਹੁੰਦਾ ਹੈਗਾ ਹੈ ਇਸ ਲਈ ਆਪਾਂ ਸਰਕਾਰ ਤੋਂ ਇਹੀ ਮਦਦ ਮੰਗ ਸਕਦੇ ਹਾਂ ਕਿ ਲੋਕਾਂ ਦੀਆਂ ਜੀਵਨ ਨੂੰ ਪੱਧਰ ਨੂੰ ਉੱਚਾ ਚੁੱਕਣ ਲਈ ਇਹਨਾਂ ਸਭ ਚੀਜ਼ਾਂ ਦਾ ਧਿਆਨ ਰੱਖਿਆ ਜਾ ਸਕੇ